ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਲਜੀਤ ਜੀ ਹਾਂਜੀ ਹਾਂਜੀ ਦੱਸੋ ਠੀਕ ਹੈ ਜੀ ਆਪਣੇ ਬਾਬਾ ਫ਼ਰੀਦ ਜੀ ਦੇ ਬਾਰੇ ਠੀਕ ਹੈ ਜੀ ਹਾਂਜੀ ਆਪਣੇ ਬਾਬਾ ਫ਼ਰੀਦ ਜੀ ਦਾ ਇਤਿਹਾਸ ਤੁਹਾਨੂੰ ਮੈਂ ਦੱਸ ਦਿੰਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਬਾਬਾ ਫ਼ਰੀਦ ਜੀ ਦਾ ਨਾਮ ਪੂਰਾ ਸੀਗਾ ਫ਼ਰੀਦ ਉਦ ਦੀਨ ਮਸੂਦ ਗੰਜ ਸ਼ਕਰ ਇਹ ਜੋ ਹੁਣ ਆਮ ਤੌਰ 'ਤੇ ਬਾਬਾ ਫ਼ਰੀਦ ਜੀ ਜਾਂ ਸ਼ੇਖ ਫ਼ਰੀਦ ਜੀ ਵਜੋਂ ਜਾਣਿਆ ਜਾਂਦਾ ਹਾਂਜੀ ਅਤੇ ਜਿਹੜੇ ਆਪਣੇ ਬਾਬਾ ਫ਼ਰੀਦ ਜੀ ਸੀਗੇ ਤੇਰ੍ਹਵੀਂ ਸਦੀ ਦਾ ਜਿਹੜੇ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ ਹੈ ਨਾ ਕਵੀ ਅਤੇ ਜਾਂ ਆਪਣਾ ਰਾਸ਼ਟਰਵਾਦੀ ਸੀਗੇ ਹਾਂਜੀ ਉਹ ਪੰਜਾਬੀ ਮੁਸਲਿਮਾਂ 'ਤੇ ਆਪਣੇ ਜਿਹੜੇ ਹਿੰਦੂ ਹੋ ਗਏ ਹੈ ਨਾ ਜਾਂ ਸਿੱਖਾਂ ਦੁਆਰਾ ਸਤਿਕਾਰ ਸਤਿਕਾਰਿਆ ਜਾਂਦਾ ਜਿਹੜੇ ਆਪਣੇ ਬਾਬਾ ਫ਼ਰੀਦ ਜੀ ਨੇ ਜਿਹੜੇ ਤਿੰਨਾਂ ਵਜੋਂ ਸਤਿਕਾਰਿਆ ਜਾਂਦਾ ਜਿਹਨੂੰ ਹਾਂਜੀ ਅਤੇ ਜੇ ਬਾਬਾ ਫ਼ਰੀਦ ਜੀ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਚਾਰ ਅਪ੍ਰੈਲ ਨੂੰ ਗਿਆਰ੍ਹਾਂ ਸੌ ਅਠਾਸੀ ਨੂੰ ਹੋਇਆ ਸੀਗਾ ਜੀ ਕੋਠੇਵਾਲ ਜੋ ਕਿ ਹੁਣ ਪਾਕਿਸਤਾਨ ਪੰਜਾਬ ਵਿੱਚ ਹੈ ਹਾਂਜੀ ਹਾਂਜੀ ਅਤੇ ਬਾਕੀ ਸਿੱਖਿਆ ਬਾਰੇ ਜੇ ਮੈਂ ਤੁਹਾਨੂੰ ਗੱਲ ਕਰਾਂ ਹੈ ਨਾ ਵੀ ਬਾਬਾ ਫ਼ਰੀਦ ਜੀ ਦੀ ਸਿੱਖਿਆ ਬਾਰੇ ਜੇ ਤੁਹਾਨੂੰ ਮੈਂ ਦੱਸਾਂ ਤਾਂ ਕਿ ਜਿਹੜੇ ਉਨ੍ਹਾਂ ਦੇ ਪਿਤਾ ਸੀ ਨਾ ਬਾਬਾ ਫ਼ਰੀਦ ਜੀ ਦੇ ਵੀ ਅਠਾਰ੍ਹਾਂ ਮਹੀਨੇ ਦੀ ਉਮਰ ਵਿੱਚ ਵੀ ਬਾਬਾ ਫ਼ਰੀਦ ਜੀ ਸੀਗੇ ਅਠਾਰ੍ਹਾਂ ਮਹੀਨੇ ਦੀ ਉਮਰ ਵਿੱਚ ਅਤੇ ਉਹ ਛੱਡ ਗਏ ਮਤਲਬ ਵੀ ਗੁਜ਼ਰ ਗਏ ਸੀਗੇ ਉਨ੍ਹਾਂ ਦੇ ਪਿਤਾ ਜੀ ਅਤੇ ਜਿਹੜੇ ਉਨ੍ਹਾਂ ਦੇ ਮਾਤਾ ਜੀ ਸੀਗੇ ਹੈ ਨਾ ਜੀ ਅਤੇ ਕੁਰਸੂਮ ਸੀ ਉਨ੍ਹਾਂ ਦਾ ਨਾਂ ਅਤੇ ਮਤਲਬ ਕਿ ਉਨ੍ਹਾਂ ਨੂੰ ਪਾਲ ਕੇ ਹੈ ਨਾ ਵੀ ਧਾਰਮਿਕ ਵਿੱਦਿਆ ਦਿੱਤੀ ਗਈ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਮਾਤਾ ਜੀ ਨੇ ਉਨ੍ਹਾਂ ਨੂੰ ਹਾਂਜੀ ਅਤੇ ਬਾਕੀ ਬਾਬਾ ਫ਼ਰੀਦ ਜੀ ਜਿਹੜੇ ਆਪਣੇ ਮੰਜੀਤ ਮੌਲਾ ਮੌਲਾਨਾ ਨਾਮ ਤੋਂ ਅਤੇ ਆਪਣੇ ਹੈਗੇ ਹੈ ਜੀ ਅਤੇ ਉਨ੍ਹਾਂ ਕੋਲੋਂ ਫੇਰ ਉਨ੍ਹਾਂ ਪੜ੍ਹੇ ਬਾਬਾ ਫ਼ਰੀਦ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਮੈਂ ਬਾਬਾ ਫ਼ਰੀਦ ਜੀ ਬਾਰੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇਤੀ ਹੈ ਅਤੇ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਹੋਰ ਵੀ ਕਿਤੇ ਲੋੜ ਪਈ ਤਾਂ ਦੱਸ ਦਿਓ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਆਪਣੇ ਬਾਬਾ ਫ਼ਰੀਦ ਦੇ ਹੈ ਨਾ ਨਾਂ ਤੋਂ ਬਾਬਾ ਫ਼ਰੀਦ ਜੀ ਦਾ ਟਿੱਲਾ ਤਾਂ ਹੈਗਾ ਅਤੇ ਟਿੱਲਾ ਵੀ ਬਹੁਤ ਮਸ਼ਹੂਰ ਹੈ ਹਾਂਜੀ ਕਿਉਂਕਿ ਇੱਥੇ ਆਪਣਾ ਬਾਬਾ ਫ਼ਰੀਦ ਜੀ ਨੇ ਖੁਦ ਆਹ ਥਾਂ 'ਤੇ ਕੰਮ ਕੀਤਾ ਹੋਇਆ ਸੀਗਾ ਟਿੱਲਾ ਜੀ ਦੀ ਜਦੋਂ ਬਣਤਰ ਬਣ ਰਹੀ ਸੀ ਨਾ ਜੀ ਇਹਦਾ ਕੰਮ ਚੱਲ ਰਿਹਾ ਸੀ ਬਾਬਾ ਫ਼ਰੀਦ ਜੀ ਦਾ ਇੱਥੇ ਹਾਂਜੀ ਉਹ ਜਿਸ ਮੁੱਢ ਨੂੰ ਬਾਬਾ ਫ਼ਰੀਦ ਜੀ ਨੇ ਹੱਥ ਲਾਇਆ ਸੀ ਉਹ ਮੁੱਢ ਆਪਣੇ ਦੋ ਥਾਂ ਬਣੀ ਹੋਈ ਹੈ ਬਾਬਾ ਫ਼ਰੀਦ ਜੀ ਦਾ ਟਿੱਲਾ ਹੈ ਨਾ ਉਹ ਮੁੱਢ ਉੱਥੇ ਪਿਆ ਹੋਇਆ ਠੀਕ ਹੈ ਜੀ ਠੀਕ ਹੈ ਕੋਈ ਨਹੀਂ